ਹਾਂਜੀ ਮੈਂ ਆਪਣੇ ਵਿਹੜੇ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਬੂਟੇ ਲਗਾਏ ਹਨ ਕਿਉਂਕਿ ਮੈਨੂੰ ਇਹ ਲਗਾਉਣੇ ਬਹੁਤ ਪਸੰਦ ਹਨ ਅਤੇ ਜਿਸ 'ਤੇ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਰੋਜ਼ ਆ ਕੇ ਅ ਬੈਠਦੇ ਹਨ ਅਤੇ ਮੈਨੂੰ ਉਹ ਬਹੁਤ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਮੈਂ ਪੰਛੀਆਂ ਦੀ ਬਹੁਤ ਦੇਖ ਭਾਲ ਕਰਦੀ ਹਾਂ ਜਿਸ ਕਰਕੇ ਮੈਂ ਰੋ ਹਰ ਰੋਜ਼ ਉਨ੍ਹਾਂ ਨੂੰ ਚਾਵਲ ਦੇ ਦਾਣੇ ਕਣਕ ਦੇ ਦਾਣੇ ਅਤੇ ਪਾਣੀ ਰੱਖਦੀ ਹਾਂ ਕਿਉਂਕਿ ਇਹ ਉਨ੍ਹਾਂ ਲਈ ਬਹੁਤ ਚੰਗਾ ਹੁੰਦਾ ਹੈ ਪੰਛੀਆਂ ਨੂੰ ਅਨਾਜ ਦੇਣਾ ਅਤੇ ਪਾਣੀ ਦੇਣਾ ਇੱਕ ਬਹੁਤ ਹੀ ਵੱਡੀ ਕਲਾ ਅਤੇ ਚੰਗਾ ਕੰਮ ਹੈ ਜੋ ਕਿ ਇੱਕ ਪੁੰਨ ਮੰਨਿਆ ਗਿਆ ਹੈ